ਹੈਲੋ ਹੈਲੋ ਮੈਂ ਸੀਮਾ ਬੋਲਦੀ ਪਈ ਬਸ ਠੀਕ ਹੈ ਮੈਂ ਧਰਮਸ਼ਾਲਾ ਤਾਂ ਆਈ ਆ ਨਾ ਹਮ ਹਾਂ ਹਾਂ ਉਹੀ ਉਹੀ ਉਹੀ ਹਾਂਜੀ ਓਈ ਹਾਂ ਹੋਰ ਕੀ ਹਾਲ ਚਾਲ ਹੈ ਬਸ ਠੀਕ ਹੈ ਤੁਸੀ ਸਣਾਓ ਕੀ ਆ ਕੀ ਕਰਦੇ ਪਏ

ਅੱਛਾ ਅੱਛਾ ਅਤੇ ਮੈਂ ਘੁੰਮਣਾ ਚਾਹੁੰਦੀ ਹਾਂਜੀ ਮਿਲ ਗਿਆ ਸੀ ਮੈਂ ਘੁੰਮਣ ਜਾਣਾ ਸੀ ਹੁਸ਼ਿਆਰਪੁਰ ਤੋਂ ਪੁੱਛਣਾ ਕਿੜ ਕਿੱਦਾਂ ਜਾਣਾ ਘੁੰਮਣ ਕਿੱਥੇ ਕਿੱਥੇ ਜਾਵਾਂ ਹਾਂਜੀ ਹਾਂਜੀ ਹਾਂਜੀ ਮਿਲ ਗਿਆ ਉੱਥੇ ਪੀਜੀ ਤਾਂ ਮਿਲ ਗਿਆ ਹਾਂ ਹਾਂ ਦੋਸਤ ਵੀ ਆਏ ਮੇਰੇ ਹਾਂਜੀ ਹਾਂ ਅੱਛਾ ਅੱਛਾ ਹਮ ਹਮ ਠੀਕ ਆ ਜੀ ਫਿਰ ਕੈ ਕੈ ਕੈਬ ਕਿੱਦਾਂ ਜਾਣਾ ਕੈਬ ਵਗੈਰਾ ਮਿਲਦੀ ਕਿੱਦਾਂ ਜਾਣਾ ਹੁੰਦਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਅੱਛਾ ਜੀ

ਅੱਛਾ ਬਸ ਅੱਛਾ ਅੱਛਾ

ਅੱਛਾ ਅੱਛਾ ਅੱਛਾ ਜੀ ਅੱਛਾ ਜੀ ਹਮ ਠੀਕ ਹੈ ਠੀਕ ਹੈ ਆਟੋ ਵਗੈਰਾ ਚਾਹੋ ਔ ਆਟੋ ਵਗੈਰਾ ਚਲਦੇ ਸਭ ਕੁਝ ਚਲਦਾ ਫਿਰ ਤਾਂ ਹਾਂਜੀ ਅੱਛਾ ਹਾਂ ਹਾਂ ਅੱਛਾ ਜੀ ਅੱਛਾ ਠੀਕ ਹੈ ਠੀਕ ਅੱਛਾ ਅੱਛਾ ਜੀ

ਅੱਛਾ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਹਮ ਠੀਕ ਹੈ ਜੀ ਹਾਂ ਅੱਛਾ ਅੱਛਾ ਸਭ ਕੁਛ ਆ ਅੱਛਾ ਅੱਛਾ ਠੀਕ ਆ ਹਮ ਠੀਕ ਹੈ ਜੀ ਅੱਛਾ ਓਕੇ ਜੀ ਠੀਕ ਹੈ ਜੀ ਓਕੇ ਧੰਨਵਾਦ ਜੀ ਠੀਕ ਹੈ ਠੀਕ ਹੈ ਆਹ ਕੋਈ ਨਹੀਂ ਕੋਈ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ ਓਕੇ ਜੀ ਧੰਨਵਾਦ ਜੀ ਧੰਨਵਾਦ ਠੀਕ